ਪੌਦਾਂ ਦੀਆਂ ਕਿਸਮਾਂ ਤਾਂ ਭਾਰਤ ਵਿੱਚ ਅਨੇਕਾਂ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ ਜਿਨ੍ਹਾਂ ਵਿੱਚ ਪੰਜਾਬ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਲਗ ਪਾਪੂਲਰ ਸਫੈਦਾ ਨਿੰਮ ਆਦਿ ਜਿਹਨਾਂ ਦਾ ਜ਼ਿਆਦਾਤਰ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਛਾਂ ਵਾਸਤੇ ਅਤੇ ਕਮਾਈ ਦਾ ਵੀ ਇੱਕ ਰੋਜ਼ਗਾਰ ਦਾ ਵੀ ਸਾਧਨ ਹੈ ਅਤੇ ਫਲਾਂ ਦੇ ਵਿੱਚ ਜਿਵੇਂ ਜ਼ਿਆਦਾਤਰ ਲੋਕ ਅਮਰੂਦ ਅਨਾਰ ਕੀਨੂੰ ਕੇਲੇ ਜੋ ਕਿ ਇੱਕ ਆਪਣਾ ਇੱਕ ਕਮਾਈ ਦਾ ਵੀ ਚੰਗਾ ਜ਼ਰੀਆ ਹੈ ਅਤੇ ਸਮੇਂ ਦੇ ਸਮੇਂ ਆਪਾਂ ਨੂੰ ਫਲ ਦਿੰਦੇ ਹਨ ਸੀਜਨ ਦੇ ਸੀਜਨ ਅਸੀਂ ਫਲ ਖਾਂਦੇ ਹਾਂ ਜਿਹਦੇ ਨਾਲ ਆਪਣੀ ਸਿਹਤ ਤੰਦਰੁਸਤ ਰਹਿੰਦੀ ਹੈ ਅਮਰਵੇਲ ਜਿਹੜੀ ਕਿ ਫੁੱਲਾਂ ਦੇ ਵਿੱਚ ਆਪਣੀ ਹੈਗੀ ਜਿਵੇਂ ਆਪਾਂ ਦਾਬ ਲਾ ਲੈਂਦੇ ਹਾਂ ਗੁਲਾਬ ਦੇ ਫੁੱਲਾਂ ਦੀ ਗੈਂਦੇ ਦੇ ਫੁੱਲ ਹੋ ਗਏ ਤੋਰੀ ਦੀਆਂ ਤੋਰੀਆਂ ਦੀਆਂ ਜਿਹੜੀਆਂ ਵਾ ਵੇਲਾਂ ਆਪਾਂ ਲਾ ਲੈਂਦੇ ਹਾਂ ਇਸ ਤਰ੍ਹਾਂ ਵੇਲਾ ਵੀ ਆਪਾਂ ਘਰ ਘਰ ਦੇ ਵਿੱਚ ਹੀ ਇਹਦੀ ਪੈਦਾਵਾਰ ਹੁੰਦੀ ਹੈ